ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਦੀ ਮੇਰਾ ਬੇਟਾ ਤਾਂ ਜੀ ਤੁਹਾਨੂੰ ਪਤਾ ਹੀ ਹੈ ਦੀਦੀ ਅਕਾਲ ਅਕੈਡਮੀ 'ਚ ਆ ਹਾਂਜੀ ਹਾਂਜੀ ਹਾਂਜੀ ਦੀ ਆਪਣੇ ਇੱਥੇ ਨਾ ਸਕੂਲ ਤਾਂ ਸਾਰੇ ਹੀ ਵਧੀਆ ਨੇ ਵੀ ਜਿਵੇਂ ਆਪਣੇ ਇੱਧਰ ਹੋ ਗਿਆ ਹੈ ਨਾ ਆਪਣਾ ਇੱਕ ਤਾਂ ਡੇਰਾ ਭਾਈ ਮਸਤਾਨ ਆ ਗਿਆ ਦੀਦੀ ਹੈ ਨਾ ਹਾਂ ਇੱਥੇ ਵੀ ਵਧੀਆ ਇੱਥੇ ਨਾਲ ਤਾਂ ਪੜ੍ਹਾਈ ਵੀ ਵਧੀਆ ਹੈਨਾ ਨਾਲੇ ਬੱਚਿਆਂ ਨੂੰ ਐਕਟੀਵਿਟੀ ਵੀ ਵਧੀਆ ਕਰਵਾਈ ਜਾਂਦੀ ਆ ਹੈ ਨਾ ਅਤੇ ਹੋਰ ਜਿਵੇਂ ਇੱਕ ਹੈਗਾ ਆਪਣੇ ਐਚ ਐਸ ਐਚ ਐਸ ਆ ਸਕੂਲ ਉਹ ਵੀ ਵਧੀਆ ਹੈ ਹੈ ਨਾ ਅਤੇ ਇੱਕ ਜਿਵੇਂ ਹਾਂਜੀ ਹਾਂਜੀ ਦੀ ਫੀਸ ਤਾਂ ਨਾ ਜ਼ਿਆਦੇ ਨਹੀਂ ਹੁੰਦੀ ਹੈ ਨਾ ਵੀ ਉਹ ਆਪਾਂ ਨੂੰ ਐਂ ਹੁੰਦਾ ਚਲੋ ਜੇ ਬੱਚਾ ਆਪਣਾ ਵਧੀਆ ਪੜ੍ਹਦਾ ਹੈ ਨਾ ਤਾਂ ਫੀਸ ਦਾ ਵੀ ਨਹੀਂ ਕੋਈ ਹੁੰਦਾ ਵੀ ਬਸ ਉਹ ਥੋੜ੍ਹਾ ਜਿਹਾ ਇੱਕ ਵਾਰ ਹੁੰਦਾ ਆਪਾਂ ਨੂੰ ਫੀਸ ਦਾ ਫਿਰ ਜਿਵੇਂ ਤੁਸੀਂ ਕਹਿੰਦੇ ਵੀ ਦੋ ਬੱਚੇ ਲਾਉਣੇ ਆ ਹੈਨਾ ਅਤੇ ਉਹ ਫਿਰ ਉਸ ਹਿਸਾਬ ਨਾਲ ਦੋ ਬੱਚਿਆਂ ਦਾ ਥੋੜ੍ਹਾ ਜਿਹਾ ਲੈਸ ਵੀ ਕਰ ਲੈਂਦੇ ਨੇ ਹੈਨਾ ਇੱਥੇ ਆਪਣੇ ਇੱਕ ਲੀਟਲ ਫਲਾਵਰ ਆ ਦੀਦੀ ਉਹ ਵੀ ਬਹੁਤ ਵਧੀਆ ਸਕੂਲ ਆ ਲਿਟਲ ਫਲਾਵਰ ਉੱਥੇ ਸਾਰੇ ਤਰ੍ਹਾਂ ਦੀ ਬੱਚਿਆਂ ਨੂੰ ਐਕਟੀਵਿਟੀ ਵੀ ਕਰਵਾਈ ਜਾਂਦੀ ਹੈ ਨਾ ਜਿਵੇਂ ਬੱਚਿਆਂ ਨੂੰ ਹਰੇਕ ਹਾਂ ਹਾਂ ਬੱਚਿਆਂ ਨੂੰ ਸਾਰਾ ਹਾਂ ਸਾਰਾ ਦੇਖਿਆ ਜਾਂਦਾ ਵੀ ਜਿਵੇਂ ਬੱਚਿਆਂ ਦਾ ਇੰਟਰਸਟ ਆ ਜਿਹੜੀ ਚੀਜ਼ 'ਚ ਹੈਨਾ ਬੱਚਿਆਂ ਨੂੰ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਗਾਈਡ ਵੀ ਕੀਤਾ ਜਾਂਦਾ ਹੈ ਵੀ ਉੱਥੇ ਵੱਖ ਵੱਖ ਵੀ ਜਿਵੇਂ ਨੂੰ ਥੋੜੇ ਥੋੜੇ ਟਾਈਮ ਬਾਅਦ ਜਿਵੇਂ ਫੰਕਸ਼ਨ ਹੁੰਦੇ ਨੇ ਹੈ ਨਾ ਉੱਤੇ ਸਹੀ ਕਿੰਨੇ ਤਰ੍ਹਾਂ ਦਾ ਵੀ ਕਰਵਾਇਆ ਜਾਂਦਾ ਫੰਕਸ਼ਨ ਦੇ ਵਿੱਚ ਹਰੇਕ ਬੱਚੇ ਦਾ ਪਾਰਟੀਸਪੇਟ ਜ਼ਰੂਰੀ ਹੁੰਦਾ ਹੈ ਨਾ ਅਤੇ ਉਹ ਵਧੀਆ ਕਰਵਾਉਂਦੇ ਨੇ ਹੈ ਨਾ ਅਤੇ ਬਾਕੀ ਰਹੀ ਹਾਂ ਰਹੀ ਗੱਲ ਹੋਰ ਵੀ ਆਪਣੇ ਹੈਗੇ ਨੇ ਸਕੂਲ ਉਹ ਵੀ ਸਾਰੇ ਵਧੀਆ ਨੇ ਹੈ ਨਾ ਹਾਂ ਅਤੇ ਤੁਸੀਂ ਦੋਨਾਂ ਨੂੰ ਲਾਉਣਾ ਦੀਦੀ ਹਾਂਜੀ ਹਾਂਜੀ ਹਾਂਜੀ ਨਹੀਂ ਦੀਦੀ ਹਾਂਜੀ ਕੋਈ ਗੱਲ ਨਹੀਂ ਉਹ ਤਾਂ ਬਹੁਤ ਹੁੰਦਾ ਹੈ ਕੋਈ ਨਹੀਂ ਜੇ ਤੁਸੀਂ ਇੱਧਰ ਉਹ ਕਰਵਾਉਣਾ ਤਾਂ ਉੱਧਰ ਆਪਾਂ ਚੱਲ ਵੜਾਂਗੇ ਅਤੇ ਵੀ ਆਪਾਂ ਥੋੜ੍ਹਾ ਬਹੁਤਾ ਲੈਸ ਵੀ ਕਰਵਾ ਲਵਾਂਗੇ ਹੈ ਨਾ ਹਾਂ ਹਾਂ ਨਹੀਂ ਨਹੀਂ ਉਹ ਦੀਦੀ ਨਾਲ ਪਤਾ ਕੀ ਹੁੰਦਾ ਜਿਵੇਂ ਹੁਣ ਆਪਾਂ ਮੰਨ ਕੇ ਚਲਦੇ ਹਾਂ ਹੈ ਨਾ ਅੱਜ ਕੱਲ੍ਹ ਚੱਲਦਾ ਤਾਂ ਇੰਗਲਿਸ਼ ਦਾ ਜ਼ਿਆਦਾ ਉਹ ਹੈ ਪਰ ਪੰਜਾਬੀ ਨਾਲ ਕਰਵਾਉਂਦੇ ਨਹੀਂ ਵੀ ਉਹ ਆਪਣਾ ਜਿਹੜਾ ਵੀ ਆਪਾਂ ਹਾਂ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਹਾਂ ਪੰਜਾਬੀ ਵੀ ਕਰਵਾਉਂਦੇ ਆ ਨਾਲ ਸਬਜੈਕਟ ਹੁੰਦਾ ਪੰਜਾਬੀ ਹਿੰਦੀ ਅਤੇ ਇੰਗਲਿਸ਼ ਬੱਚਿਆਂ ਨੂੰ ਵੀ ਜ਼ਿਆਦੇ ਉਹ ਕਰਵਾਉਂਦੇ ਨੇ ਕਿਉਂਕਿ ਅੱਜ ਕੱਲ੍ਹ ਜੇ ਹੁਣ ਆਪਾਂ ਦੇਖੀਏ ਤਾਂ ਬੱਚਿਆਂ ਨੂੰ ਜ਼ਿਆਦੇ ਇੰਗਲਿਸ਼ ਦਾ ਵੀ ਆਉਣੀ ਜ਼ਰੂਰੀ ਆ ਹੈ ਨਾ ਵੀ ਚਲੋ ਆਪਣੇ ਵੇਲੇ ਤਾਂ ਹੁੰਦਾ ਸੀਗਾ ਆਪਾਂ ਹੁਣ ਤਾਂ ਵੈਸੇ ਜੇ ਆਪਾਂ ਮੰਨ ਕੇ ਚੱਲੀਏ ਤਾਂ ਜਿਹੜੇ ਸਰਕਾਰੀ ਸਕੂਲ ਆ ਦੀਦੀ ਉਹ ਵੀ ਬਹੁਤ ਵਧੀਆ ਹੈ ਸਮਾਰਟ ਸਕੂਲ ਹੋ ਗਏ ਵੀ ਮਤਲਬ ਵਧੀਆ ਕਲਾਸਾਂ ਲੱਗਦੀਆਂ ਨੇ ਉੱਥੇ ਵੀ ਕੋਆਲੀਫਾਈ ਟੀਚਰ ਨੇ ਵਧੀਆ ਅਤੇ ਆਪਣੇ ਵੇਲੇ ਤਾਂ ਚਲੋ ਹੁੰਦਾ ਨਹੀਂ ਸੀ ਹੁਣ ਤਾਂ ਵੀ ਜਿਵੇਂ ਸਾਰੇ ਵਧੀਆ ਸਕੂਲ ਨੇ ਸਰਕਾਰੀ ਵੀ ਅਤੇ ਪਰ ਫਿਰ ਵੀ ਜੇ ਤੁਸੀਂ ਜਾਣਾ ਹੈ ਹੈਨਾ ਜਿਵੇਂ ਆਪਾਂ ਕੋਈ ਗੱਲ ਨਹੀਂ ਜਦੋਂ ਤੁਹਾਡੇ ਕੋਲ ਟੈਮ ਹੋਇਆ ਆਪਾਂ ਸਕੂਲ ਚਲੇ ਜਾਵਾਂਗੇ ਅਤੇ ਮੈਂ ਤੁਹਾਡੇ ਨਾਲ ਚਲੀ ਜਾਊਂਗੀ ਅਤੇ ਆਪਾਂ ਐਡਮੀ ਹਾਂ ਕੋਈ ਗੱਲ ਨਹੀਂ ਤੁਸੀਂ ਜਦੋਂ ਕਹੋਗੇ ਤੁਹਾਡੇ ਕੋਲ ਟੈਮ ਹੋਇਆ ਨਾ ਤਾਂ ਆਪਾਂ ਚਲੇ ਜਾਵਾਂਗੇ ਹਾਂ ਬਾਕੀ ਤੁਸੀਂ ਦੱਸ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਫਿਰ ਆਪਾਂ ਐਂ ਕਰਾਂਗੇ ਤੁਸੀਂ ਕੱਲ੍ਹ ਦੱਸ ਜਦੋਂ ਵੀ ਤੁਹਾਡੇ ਕੋਲ ਟੈਮ ਹੋਇਆ ਤੁਸੀਂ ਮੈਨੂੰ ਦੱਸ ਦਿਓ ਅਤੇ ਆਪਾਂ ਜਾਂਦੇ ਰਵਾਂਗੇ ਹਾਂ ਚਲੋ ਠੀਕ ਆ ਦੀਦੀ ਫਿਰ ਮਿਲਦੇ ਹਾਂ ਆਪਾਂ ਹਾਂਜੀ